ਮੈਂ ਪਿਛਲੇ ਹੀ ਮਹੀਨੇ ਯੋਗਾ ਕਲਾਸਿਜ ਜੁਆਇਨ ਕੀਤੀਆਂ ਹਨ ਅਤੇ ਮੇਰੇ ਪਹਿਲੀ ਯੋਗਾ ਕਲਾਸ ਦਾ ਵਰਨਣ ਮੈਂ ਇਸ ਤਰ੍ਹਾਂ ਕਰਦਾ ਹਾਂ ਕਿ ਮੇਰਾ ਅਨੁਭਵ ਬਹੁਤ ਹੀ ਚੰਗਾ ਅਤੇ ਯਾਦਗਾਰ ਰਿਹਾ ਮੈਂ ਪਹਿਲੇ ਦਿਨ ਬਹੁਤ ਖੁਸ਼ ਸੀ ਕਿਉਂਕਿ ਮੈਂ ਕੁਛ ਨਵਾਂ ਸਿੱਖਣ ਜਾ ਰਿਹਾ ਸੀ ਅਤੇ ਪਹਿਲਾਂ ਮੈਂ ਕਦੇ ਵੀ ਯੋਗਾ ਕਲਾਸਿਜ਼ ਜੁਆਇਨ ਨਹੀਂ ਕੀਤੀਆਂ ਸਨ ਅਤੇ ਕਲਾਸ ਦੇ ਦੌਰਾਨ ਮੈਨੂੰ ਬਹੁਤ ਨਵੇਂ ਤਰ੍ਹਾਂ ਦੇ ਯੋਗਾ ਆਸਣ ਸਿੱਖਣ ਨੂੰ ਮਿਲੇ ਅਤੇ ਮੈਂ ਉਹਨਾਂ ਨੂੰ ਘਰ ਵਾਪਿਸ ਆ ਕੇ ਵੀ ਦੁਹਰਾਇਆ ਅਤੇ ਕਲਾਸ ਵਿੱਚ ਮੈਨੂੰ ਬਹੁਤ ਸਾਰੇ ਲੋਕ ਮਿਲੇ ਜਿਨ੍ਹਾਂ ਨਾਲ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਮੇਰਾ ਸਮਾਂ ਬਹੁਤ ਚੰਗਾ ਬੀਤਿਆ